ਮੇਰਾ ਇੱਕ ਦੋਸਤ ਸੀ ਉਸਦੀ ਦੁਕਾਨ ਇੱਕ ਬਹੁਤ ਜੀ ਛੋਟੀ ਜਿਹੀ ਗਲੀ ਵਿੱਚ ਸੀ ਉਸ ਦੇ ਕੋਲ ਬਹੁਤ ਹੀ ਘੱਟ ਗਾਹਕ ਆਉਂਦੇ ਸਨ ਉਸ ਨੇ ਇਸ ਬਾਰੇ ਮੇਰੇ ਨਾਲ ਗੱਲ ਕੀਤੀ ਅਤੇ ਮੈਂ ਉਸ ਨੂੰ ਕਿਹਾ ਕਿ ਆਪਣੇ ਸਾਰੇ ਪ੍ਰੋਡਕਟ ਔਨਲਾਈਨ ਰਾਹੀਂ ਵੇਚਣਾ ਸ਼ੁਰੂ ਕਰ ਮੈਂ ਉਸ ਨੂੰ ਇਸ ਲਈ ਕਿਹਾ ਸੀ ਕਿਉਂਕਿ ਮੈਂ ਵੀ ਬਹੁਤ ਸਾਰਾ ਸਮਾਨ ਔਨਲਾਈਨ ਰਾਹੀਂ ਮਗਵਾਉਂਦਾ ਸੀ ਉਸ ਨੇ ਫਿਰ ਟਕਨੋਲਜੀ ਦੀ ਵਰਤੋਂ ਕਰਕੇ ਆਪਣੇ ਸਾਰੇ ਪ੍ਰੋਡਕਟ ਆਪਣੇ ਵੇਚਣ ਵਾਲਾ ਸਾਰਾ ਸਮਾਨ ਉਹਨੇ ਔਨਲਾਈਨ ਫਲਿੱਪਕਾਰਟ 'ਤੇ ਪਾਇਆ ਫਿਰ ਉਸ ਨੂੰ ਬਹੁਤ ਹੀ ਚੰਗੇ ਚੰਗੇ ਓਡਰ ਆਉਣੇ ਸ਼ੁਰੂ ਹੋ ਗਏ ਇਸ ਤੋਂ ਬਾਅਦ ਉਸ ਨੇ ਹੁਣ ਇੱਕ ਸਾਲ ਦੇ ਵਿੱਚ ਆਪਣਾ ਇੱਕ ਸ਼ੋਅਰੂਮ ਮੇਨ ਰੋਡ 'ਤੇ ਖੋਲ੍ਹ ਲਿਆ ਹੈ ਅਤੇ ਪੰਜ ਬੰਦੇ ਵੀ ਰੱਖ ਲਏ ਨੇ ਇਸ ਕਰਕੇ ਇਸ ਤਰ੍ਹਾਂ ਉਹ ਦੂਜਿਆਂ ਨੂੰ ਵੀ ਦੱਸਦਾ ਹੈ ਕਿ ਟੈਕਨੌਲਜੀ ਦੀ ਵਰਤੋਂ ਕਰੋ ਆਪਣੇ ਆਪਣੇ ਕਾਰੋਬਾਰ 'ਚ ਵਿਕਾਸ 'ਚ ਵਾਧਾ ਕਰੋ ਉਹ ਟਕਨੋਲਜੀ ਅਤੇ ਕੰਪਿਊਟਰ ਦੀ ਵਰਤੋਂ ਕਰਕੇ ਸਾਰੇ ਸਮਾਨ ਦਾ ਹਿਸਾਬ ਕਿਤਾਬ ਕਿੰਨਾ ਸਮਾਨ ਵਿਕ ਗਿਆ ਕਿੰਨਾ ਰਹਿ ਗਿਆ ਅਤੇ ਸਾਰੇ ਪੈਸੇ ਦਾ ਅਕਾਊਂਟ ਦਾ ਹਿਸਾਬ ਵੀ ਵੀ ਟਕਨੋਲਜੀ ਨਾਲ ਅਸਾਨੀ ਨਾਲ ਕਰ ਲੈਂਦਾ ਹੈ ਇਸ ਤਰ੍ਹਾਂ ਟਕਨੋਲਜੀ ਨੇ ਛੋਟੇ ਕਾਰੋਬਾਰ ਲਈ ਬਹੁਤ ਸਹੂਲਤ ਦਿੱਤੀ ਹੈ ਟਕਨੋਲਜੀ ਨੇ ਛੋਟੇ ਕਾਰੋਬਾਰ ਲਈ ਵਿਕਾਸ ਵਿੱਚ ਬਹੁਤ ਸਾਰੀ ਮਦਦ ਕੀਤੀ ਹੈ